ਭਾਰਤ ਸਰਕਾਰ ਨੇ ਜਿਹੜੀ ਸਿੱਖਿਆ ਸ ਪ੍ਰਣਾਲੀ ਹੈ ਇਹਨੂੰ ਬਿਹਤਰ ਬਣਾਉਣ ਲਈ ਬਹੁਤ ਕੁਝ ਕੀਤਾ ਉਹਨਾਂ ਨੇ ਸ ਬੱਚਿਆਂ ਦੇ ਲਈ ਹਰ ਪਿੰਡ ਦੇ ਵਿੱਚ ਸਕੂਲ ਖੋਲ੍ਹੇ ਹੈ ਪ੍ਰਾਈਮਰੀ ਸਕੂਲ ਸਰਕਾਰੀ ਸਕੂਲ ਐਲੀਮੈਂਟਰੀ ਸਕੂਲ ਇਹਨਾਂ ਸਕੂਲਾਂ ਦੇ ਵਿੱਚ ਜਿਹੜੇ ਬੱਚਿਆਂ ਦੀ ਫੀਸ ਬਹੁਤ ਘੱਟ ਹੈ ਅਤੇ ਗਰੀਬ ਬੱਚਿਆਂ ਦੀ ਜਿਹੜੀ ਫੀਸ ਬਿਲਕੁਲ ਮਾਫ ਕੀਤੀ ਹੈ ਅਤੇ ਉਹਨਾਂ ਨੂੰ ਵਰਦੀਆਂ ਦਿੱਤੀਆਂ ਜਾਂਦੀਆਂ ਮਿਡ ਡੇ ਮੀਲ ਦੇ ਵਿੱਚ ਉਹਨਾਂ ਨੂੰ ਖਾਣਾ ਦਿੱਤਾ ਜਾਂਦਾ ਹੈ ਤਾਂ ਜੋ ਜਿਹੜੇ ਗਰੀਬ ਬੱਚਿਆਂ ਨੂੰ ਕੋਈ ਪ੍ਰੋਬਲਮ ਨਾ ਆਵੇ ਉਹਨਾਂ ਬੱਚਿਆਂ ਨੂੰ ਜਿਹੜੀ ਐਜੂਕੇਸ਼ਨ ਸ ਜਿਹੜੀ ਸਿੱਖਿਆ ਉਹ ਫਰੀ ਦਿੱਤੀ ਜਾਂਦੀ ਹੈ ਅਤੇ ਪ ਮਤਲਬ ਕਿ ਐਜੂਕੇਸ਼ਨ ਨੂੰ ਪ੍ਰਮੋਟ ਕਰਨ ਲਈ ਸਰਕਾਰ ਨੇ ਜਿਹੜੇ ਬਹੁਤ ਉਪਰਾਲੇ ਕੀਤੇ ਹੈ ਪਰ ਭਾਰਤ ਦੇ ਵਿੱਚ ਕਈ ਅਜਿਹੇ ਖੇਤਰ ਹੈ ਜਿੱਥੇ ਕੁਝ ਬੱਚਿਆਂ ਨੂੰ ਜਿਹੜਾ ਸਕੂਲ ਨਹੀਂ ਭੇਜਿਆ ਜਾਂਦਾ ਇਹਦਾ ਕਾਰਨ ਇਹ ਹੈ ਕਿ ਜਿਹੜੇ ਉਹਨਾਂ ਦੇ ਮ ਮਾਤਾ ਪਿਤਾ ਬੱਚਿਆਂ ਦੇ ਉਹਨਾਂ ਦਾ ਇਸ ਚੀਜ਼ ਵੱਲ ਧਿਆਨ ਨਹੀਂ ਉਹ ਚਾਹੁੰਦੇ ਹੈ ਕਿ ਸਾਡੇ ਬੱਚੇ ਜਿਹੜੇ ਮਜ਼ਦੂਰੀ ਕਰਨ ਪੈਸਾ ਕਮਾਉਣ ਤਾਂ ਜੋ ਉਹਨਾਂ ਦੀ ਰੋਟੀ ਦਾ ਹੀਲਾ ਹੋ ਸਕੇ ਉਹ ਤਾਂ ਆਪਣੇ ਬੱਚਿਆਂ ਨੂੰ ਜਿਹੜੀ ਸਿੱਖਿਆ ਵੱਲ ਘੱਟ ਉਹਨਾਂ ਦਾ ਇੰਟਰਸਟ ਹੈ